ਹੈਲੋ ਸਤਿ ਸ਼੍ਰੀ ਅਕਾਲ ਜੀ ਸਵੀਗੀ ਤੋਂ ਭਾਅ ਜੀ ਬੋਲ ਰਹੇ ਰਕਵੇਸ਼ ਭਾਅ ਜੀ ਸਰ ਤੁਹਾਡੇ ਕੋਲੋਂ ਪਿੱਛੇ ਜੇ ਅਸੀਂ ਮਨਚੂਰੀਅਨ ਮੰਗਵਾਇਆ ਸੀਗਾ ਦੋ ਦਿਨ ਹੋ ਗਏ ਨੇ ਅਤੇ ਉਹ ਉਸ ਤੋਂ ਬਾਅਦ 'ਚੋਂ ਕੈਂਸਲ ਕਰ ਦਿੱਤਾ ਗਿਆ ਸੀਗਾ ਮੈਨੂੰ ਕੰਮ ਪੈ ਗਿਆ ਸੀ ਮੈਂ ਜਾਣਾ ਸੀ ਕਿਤੇ ਅਤੇ ਫੈਮਿਲੀ ਨੂੰ ਕਿਹਾ ਸੀਗਾ ਲੈ ਲੈਣਾ ਬਟ ਉਹ ਉਹਨਾਂ ਨੇ ਵੀ ਉਹ ਮੇਰੇ ਕੈਂਸਲ ਕਰਨ 'ਤੇ ਹੀ ਉਹਨਾਂ ਨੂੰ ਮਿਲਿਆ ਨਹੀਂ ਅਤੇ ਮੈਂ ਚਾਹੁੰਦਾ ਕਿ ਵੀ ਮੇਰੇ ਹੁਣ ਜਿਹੜੇ ਪੈਸੇ ਕੱਟੇ ਗਏ ਨੇ ਉਹ ਕਿੰਝ ਵਾਪਸ ਆਉਣਗੇ ਜਾਂ ਕ੍ਰੈਡਿਟ ਕਰੋਗੇ ਔਨਲਾਈਨ ਪੇਮੈਂਟ ਕੀਤੀ ਸੀ ਜਿਹੜੇ ਭਾਅ ਜੀ ਦੇਣ ਆਏ ਸੀ ਸਮਾਨ ਉਹਨਾਂ ਨੂੰ ਰਸਤੇ 'ਚ ਫੋਨ ਕਰਤਾ ਸੀਗਾ ਕਿ ਭਾਅ ਜੀ ਕੈਂਸਲ ਕਰ ਦਿਉ ਉਹਨਾਂ ਨੇ ਤਾਂ ਕੈਂਸਲ ਕਰ ਤਾ ਸੀਗਾ ਆਪਣੇ ਮੋਬਾਇਲ ਦੇ ਐਪ 'ਤੇ ਵੀ ਆ ਗਿਆ ਸੀਗਾ ਕਿ ਕੈਂਸਲ ਹੋ ਚੁੱਕਿਆ ਬਟ ਉਹ ਸਾਨੂੰ ਮਿਲਿਆ ਨਹੀਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਵੀ ਸਾਡੀ ਜਿਹੜੀ ਪੇਮੈਂਟ ਹੈ ਉਹ ਤੁਸੀਂ ਔਨਲਾਈਨ ਹੀ ਟ੍ਰਾਂਸਫਰ ਕਰੋਗੇ ਜਾਂ ਤੁਹਾਡੇ ਅੋਫਿਸ ਆਉਣਾ ਪਏਗਾ ਬਾਕੀ ਰਾਕੇਸ਼ ਜੀ ਦਾ ਮੇਰੇ ਕੋਲ ਨੰਬਰ ਹੈਗਾ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਰਾਕੇਸ਼ ਜੀ ਕੋਲੋਂ ਪੁੱਛ ਸਕਦਾਂ ਅਤੇ ਉਹਨਾਂ ਨਾਲ ਮੈਂ ਗੱਲ ਕਰਕੇ ਫਿਰ ਮੈਂ ਜੋ ਵੀ ਮੈਨੂੰ ਲੱਗੇਗਾ ਫਿਰ ਉਸ ਹਿਸਾਬ ਨਾਲ ਮੈਂ ਫਿਰ ਤੁਹਾਨੂੰ ਦੁਬਾਰਾ ਕੋਲ ਕਰਕੇ ਪੁੱਛਦਾ